ਮੇਰਾ ਮਨ ਪਸੰਦ ਰਸਤਾ ਹਾਈਵੇ ਰੂ ਹੈ ਅਤੇ ਉਸਦੇ ਜੋ ਆਲੇ ਦੁਆਲੇ ਦਰੱਖਤ ਲੱਗੇ ਹੁੰਦੇ ਹਨ ਉਹ ਮੈਨੂੰ ਬਹੁਤ ਹੀ ਵਧੀਆ ਲੱਗਦੇ ਹਨ ਅਤੇ ਮੈਨੂੰ ਬਹੁਤ ਹੀ ਪ੍ਰਭਾਵਸ਼ਾਲੀ ਲੱਗਦੇ ਹਨ ਕਿਉਂਕਿ ਉਹਨਾਂ ਰਾਹੀਂ ਹਾਈਵੇ ਰੋ ਹੈ ਜੋ ਕਿ ਦਿਖਣ ਵਿੱਚ ਬਹੁਤ ਹੀ ਸੁੰਦਰ ਲੱਗਦਾ ਹੈ ਅਤੇ ਉਹ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਇਸ ਤੋਂ ਇਲਾਵਾ ਮੈਨੂੰ ਨਦੀ ਕਿਨਾਰੇ ਨਦੀ ਕਿਨਾਰੇ ਜਾਂ ਸੈਕਟਰਸ ਹੋ ਗਏ ਅਤੇ ਪਾਰਕ ਹੋ ਪਾਰਕ ਅਤੇ ਗਰਾਊਂਡ ਇਹ ਸਭ ਮੇਰੇ ਮਨ ਪਸੰਦ ਸਥਾਨ ਹਨ ਮੈਂ ਸੁਬਹਾ ਰਨਿੰਗ ਕਰਨ ਵਾਸਤੇ ਇਹਨਾਂ ਸਥਾਨਾਂ 'ਤੇ ਹੀ ਜਾਂਦਾ ਹਾਂ ਅਤੇ ਮੈਂ ਸੁਬਹਾ ਇਕੱਲਾ ਹੀ ਰਨਿੰਗ ਕਰਨ ਚਲਾ ਜਾਂਦਾ ਹਾਂ ਮੈਨੂੰ ਇਹਨਾਂ ਸਥਾਨਾਂ 'ਤੇ ਰਨਿੰਗ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਮੈਂ ਇਹਨਾਂ ਸਥਾਨਾਂ 'ਤੇ ਘੱਟੋ ਘੱਟ ਡੇਢ ਦੋ ਘੰਟੇ ਲਗਾ ਕੇ ਆਉਂਦਾ ਹਾਂ ਮੈਨੂੰ ਇਹਨਾਂ ਸਥਾਨਾਂ ਨਾਲ ਇੱਕ ਮੋਹ ਜਿਹਾ ਪੈ ਗਿਆ ਹੈ ਅਤੇ ਮੈਂ ਇਹਨਾਂ ਸਥਾਨਾਂ 'ਤੇ ਸੁਬਹਾ ਇਕੱਲਾ ਹੀ ਦੌੜ ਕਰਨ ਵਾਸਤੇ ਚਲਾ ਜਾਂਦਾ ਹਾਂ ਅਤੇ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਂਦਾ ਮੈਨੂੰ ਨਦੀ ਕਿਨਾਰੇ ਦੌੜਨਾ ਬਹੁਤ ਵਧੀਆ ਲੱਗਦਾ ਹੈ ਅਤੇ ਹਾਈਵੇ ਰੋਡ ਦੇ ਜੋ ਆਲੇ ਦੁਆਲੇ ਦਰੱਖਤ ਹੁੰਦੇ ਹਨ ਉਹਨਾਂ ਕੋਲ ਦੌੜਨਾ ਜਾਂ ਸੈਰ ਕਰਨਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਅਤੇ ਪਾਰਕ ਵਿੱਚ ਜਾ ਕੇ ਦੌੜਨਾ ਵੀ ਬਹੁਤ ਵਧੀਆ ਲੱਗਦਾ ਹੈ ਐਕਸਰਸਾਈਜ ਕਰਨੀਆਂ ਬਹੁਤ ਵਧੀਆ ਲੱਗਦੀਆਂ ਹਨ ਮੈਨੂੰ ਇਹਨਾਂ ਸ ਥਾਵਾਂ 'ਤੇ ਜਾ ਕੇ ਦੌੜਨਾ ਜਾਂ ਕਸਰਤਾਂ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਕਿਉਂਕਿ ਸੁਬਹਾ ਇਹਨਾਂ ਥਾਵਾਂ 'ਤੇ ਬਹੁਤ ਹੀ ਆਕਸੀਜਨ ਬਹੁਤ ਹੀ ਵਧੀਆ ਹੁੰਦਾ ਹੈ